ਹੈਲੋ ਹਾਂਜੀ ਹਾਂਜੀ ਮੈਂ ਨਾ ਇੱਕ ਪ੍ਰੋਡਕਟ ਖਰੀਦਿਆ ਹਾਂਜੀ ਐਮਾਜੋਨ ਤੋਂ ਸਰ ਮੈਨੂੰ ਉਹ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਸਰ ਮੈਨੂੰ ਇੰਨੀ ਉਮੀਦ ਨਹੀਂ ਸੀ ਮਤਲਬ ਕਿ ਨਾ ਮੈਂ ਜਦੋਂ ਖਰੀਦਿਆ ਮਤਲਬ ਕਿ ਮੈਂ ਕਨਫਿਊਜਨ ਦੇ ਵਿੱਚ ਸੀਗੀ ਵੀ ਵੀ ਪਤਾ ਨਹੀਂ ਕਿਵੇਂ ਦਾ ਹੋਊਗਾ ਕਿਵੇਂ ਦਾ ਹੋਊਗਾ ਜਦੋਂ ਸਰ ਮੈਂ ਉਹਨੂੰ ਹੁਣ ਯੂਜ਼ ਕਰ ਰਹੀ ਹਾਂ ਸਰ ਉਹਦੇ ਕਮਾਲ ਕਮਾਲ ਹੈ ਉਹ ਕਮਾਲ ਬਹੁਤ ਜ਼ਿਆਦਾ ਵਧੀਆ ਲੱਗਿਆ ਸਰ ਅਤੇ ਉਸ ਤੋਂ ਬਾਅਦ ਮੈਂ ਇਹ ਨਾ ਮਤਲਬ ਕਿ ਆਪਣੀਆਂ ਸਹੇਲੀਆਂ ਨੂੰ ਸਾਰੀਆਂ ਨੂੰ ਮੈਂ ਉਹਦੇ ਬਾਰੇ ਸਲਾਹ ਵੀ ਦਿੱਤੀ ਵੀ ਮਤਲਬ ਕਿ ਉਹਦੇ ਵਿੱਚ ਮੈਂ ਜਿੱਦਾਂ ਕੋਈ ਡੁਪਲੀਗੇਸੀ ਵਾਲੀ ਕੋਈ ਚੀਜ਼ ਨਹੀਂ ਸੀ ਪ੍ਰੋਡਕਟ ਮਹਿੰਗਾ ਸੀ ਮੈਨੂੰ ਇਸ ਲਈ ਬਹੁਤ ਡਰ ਲੱਗ ਰਿਹਾ ਸੀ ਇੰਨੇ ਪੈਸੇ ਮੇਰੇ ਖਰਾਬ ਨਾ ਹੋ ਜਾਣ ਪਰ ਸਰ ਖਰਾਬ ਕੀ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ ਬਹੁਤ ਫਾਇਦਾ ਹੋਇਆ ਮੈਨੂੰ ਮਤਲਬ ਕਿ ਯਕੀਨ ਨਹੀਂ ਆ ਰਿਹਾ ਮੈਨੂੰ ਪਹਿਲੀ ਵਾਰ ਇੰਨਾ ਫਾਇਦਾ ਹੋਇਆ ਹਾਂਜੀ ਸਰ ਬਹੁਤ ਜ਼ਿਆਦਾ ਵਧੀਆ ਪ੍ਰੋਡਕਟ ਹਰ ਪੱਖੋਂ ਵਧੀਆ ਸਰ ਉਹਦੀ ਬਹੁਤ ਜ਼ਿਆਦਾ ਵਧੀਆ ਮੈਨੂੰ ਮਤਲਬ ਕਿ ਦਿਨ ਬ ਦਿਨ ਉਹਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਮੈਨੂੰ ਨਹੀਂ ਮੈਨੂੰ ਪਹਿਲਾਂ ਨਹੀਂ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਮੈਂ ਸਿਰਫ ਮੋਬਾਇਲ ਦੇ ਉੱਪਰ ਹੀ ਦੇਖਿਆ ਸੀ ਉਹਦੀ ਐਡ ਦੇਖੀ ਸੀ ਹਾਂਜੀ ਮੋਬਾਈਲ ਦੇ ਉੱਪਰ ਐਡ ਦੇਖੀ ਥੋੜ੍ਹਾ ਵਿਸ਼ਵਾਸ ਕਰਿਆ ਅਤੇ ਆਰਡਰ ਕਰ ਦਿੱਤਾ ਮੈਂ ਅਤੇ ਆਰਡਰ ਕਰਨ ਤੋਂ ਪਹਿਲਾਂ ਵੀ ਮੈਨੂੰ ਥੋੜ੍ਹਾ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਪ੍ਰੋਡਕਟ ਕਿਵੇਂ ਦਾ ਹੋਏਗਾ ਪੈਸੇ ਨਾ ਮੇਰੇ ਐਵੇਂ ਬੇਕਾਰ ਜਾਣ ਪਰ ਸਰ ਜਦੋਂ ਮੈਂ ਵਰਤਿਆ ਵਰਤਣ ਤੋਂ ਬਾਅਦ ਮੈਨੂੰ ਮਤਲਬ ਕਿ ਦੋ ਚਾਰ ਦਿਨਾਂ ਦੇ ਵਿੱਚ ਹੀ ਮੈਨੂੰ ਰਿਜ਼ਲਟ ਮਿਲ ਗਿਆ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਮਿਲਿਆ ਮਤਲਬ ਕਿ ਮੈਂ ਹੁਣ ਉਹ ਪ੍ਰੋਡਕਟ ਖੁਦ ਤਾਂ ਵਰਤਣਾ ਅਤੇ ਆਪਣੇ ਮਤਲਬ ਕਿ ਜੋ ਮੇਰੇ ਨਾਲ ਦੇ ਨੇ ਜੋ ਮੇਰੇ ਨੇੜੇ ਦੇ ਨੇ ਮੈਂ ਉਹਨਾਂ ਨੂੰ ਵੀ ਉਸ ਪ੍ਰੋਡਕਟ ਦੀ ਇਹੀ ਸਲਾਹ ਦੇਵਾਂਗੀ ਕਿ ਸਭ ਤੋਂ ਵਧੀਆ ਪ੍ਰੋਡਕਟ ਹੈ ਤੁਸੀਂ ਵੀ ਇਸ ਨੂੰ ਵਰਤੋਂ